ਜੇਕਰ ਅਸੀਂ ਖੇਤੀ ਦੀ ਗੱਲ ਕਰੀਏ ਤਾਂ ਕਿਸਾਨ ਨੇ ਜਿਹੜੀਆਂ ਉਹ ਵੱਧ ਤੋਂ ਵੱਧ ਆਰਥਿਕ ਲਾਹੇ ਵਾਲੀਆਂ ਫਸਲਾਂ ਨੇ ਜਿਹੜੀਆਂ ਉਹ ਪ੍ਰਾਪਤ ਕਰਨੀਆਂ ਪਸੰਦ ਕਰਦੇ ਨੇ ਜਿਵੇਂ ਉਦਾਹਰਣ ਦੇ ਤੌਰ 'ਤੇ ਅਸੀਂ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਦੇ ਸਮੇਂ 'ਤੇ ਜਿਹੜਾ ਮੁੱਖ ਫਸਲੀ ਗੇੜਾ ਉਹ ਕਣਕ ਅਤੇ ਝੋਨਾ ਬਣ ਕੇ ਰਹਿ ਗਿਆ ਇਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਹੈ ਬੇਸ਼ੱਕ ਉਹ ਪੰਜਾਬ ਸਰਕਾਰ ਹੋਵੇ ਜਾਂ ਭਾਰਤ ਸਰਕਾਰ ਹੋਵੇ ਉਹ ਕਣਕ ਅਤੇ ਝੋਨੇ ਦੇ ਉੱਤੇ ਸਾਨੂੰ ਪੱਕਾ ਸਮਰਥਨ ਮੁੱਲ ਆ ਜਿਹੜਾ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਜਿਹਨੂੰ ਕਿ ਅਸੀਂ ਐਮ ਐਸ ਪੀ ਕਹਿੰਦੇ ਹਾਂ ਉਹ ਦਿੰਦੀ ਹੈ ਉਸਦੇ ਮਿਲਣ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇੰਨੀ ਕੁ ਸੰਤੁਸ਼ਟੀ ਹੋ ਜਾਂਦੀ ਹੈ ਵੀ ਅਗਰ ਅਸੀਂ ਇਹ ਫਸਲ ਉਗਾ ਰਹੇ ਹਾਂ ਤਾਂ ਸਾਨੂੰ ਕਮ ਸੇ ਕਮ ਐਨੀ ਕੁ ਇਨਕਮ ਹੈ ਜਿਹੜੀ ਉਹ ਹੋ ਜਾਵੇਗੀ ਕਿ ਉਹਦੇ ਵਿੱਚੋਂ ਜਿਹੜਾ ਅਸੀਂ ਫਸਲ ਉਗਾਉਣ ਦੇ ਉੱਪਰ ਖਰਚਾ ਉਹ ਵੀ ਕੱਢ ਲਵਾਂਗੇ ਉਸ ਤੋਂ ਇਲਾਵਾ ਜਿਹੜੇ ਕੁਛ ਕੁ ਪੈਸੇ ਬਚਣਗੇ ਉਹਦੇ ਨਾਲ ਅਸੀਂ ਆਪਦਾ ਪਰਿਵਾਰ ਵੀ ਪਾਲ ਲਵਾਂਗੇ ਅਤੇ ਸਾਡੇ ਜਿਹੜੇ ਬੱਚੇ ਆ ਉਹ ਵੀ ਚੰਗੀ ਤਰ੍ਹਾਂ ਪੜ੍ਹ ਲੈਣਗੇ ਸੋ ਜਿਹੜੇ ਕਿਸਾਨ ਨੇ ਅੱਜ ਦੇ ਸਮੇਂ ਦੇ ਵਿੱਚ ਉਹ ਮੁੱਖ ਤੌਰ 'ਤੇ ਆਰਥਿਕ ਲਾਹੇਵੰਦ ਜਿਹੜੀਆਂ ਫਸਲਾਂ ਨੇ ਉਹ ਪ੍ਰਾਪਤ ਕਰਨੀਆਂ ਪਸੰਦ ਕਰਦੇ ਨੇ